ਹੈਲੋ ਹੈਲੋ ਹਾਂਜੀ ਕੌਣ ਅਸੀਂ ਸ਼ੇਰੇ ਪੰਜਾਬ ਢਾਬੇ ਤੋਂ ਗੱਲ ਕਰ ਰਹੇ ਹਾਂ ਜੀ ਦੱਸੋ ਕੀ ਸੇਵਾ ਕਰੀਏ ਤੁਹਾਡੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਇਓ ਜ਼ਰੂਰ ਗੇੜਾ ਮਾਰਿਓ ਸਾਡੇ ਢਾਬੇ 'ਤੇ ਖਾਣਾ ਖਾ ਕੇ ਜਾਇਓ ਨਹੀਂ ਕੋਈ ਗੱਲ ਨਹੀਂ ਤੁਸੀਂ ਆਇਓ ਤੁਹਾਨੂੰ ਢਾਬੇ ਦਾ ਸਾਰਾ ਖਾਣਾ ਚੈੱਕ ਕਰਾਵਾਂਗੇ ਜੀ ਤੁਹਾਨੂੰ ਕੋਈ ਵੀ ਆਪਣਾ ਪੰਜਾਬੀ ਵੈਸ਼ਨੂੰ ਢਾਬਾ ਹੀ ਸਾਰਾ ਵੈਸ਼ਨੂੰ ਖਾਣਾ ਮਿਲੂਗਾ ਆਪਣੇ ਕੋਲ ਪੰਜਾਬੀ ਖਾਣਾ ਜਿਵੇਂ ਕੜੀ ਪਕੌੜਾ ਸਾਗ ਦਾਲ ਮੱਖਣੀ ਮਿਕਸ ਸਬਜ਼ੀ ਅਤੇ ਹੁਣ ਸਰਦੀਆਂ 'ਚ ਜਿਵੇਂ ਜ਼ਿਆਦਾਤਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਸਾਰਾ ਪਿਓਰ ਪੰਜਾਬੀ ਖਾਣਾ ਹਾਂਜੀ ਸਾਰਾ ਪੰਜਾਬੀ ਖਾਣਾ ਮਿਲੂਗਾ ਜੀ ਹਾਂਜੀ ਹਾਂਜੀ ਮਿੱਠੀ ਲੱਸੀ ਨਮਕੀਨ ਲੱਸੀ ਨਹੀਂ ਨਹੀਂ ਆਪਣੇ ਕੋਲ ਸਾਰੀ ਚੀਜ਼ ਅਵੇਲੇਬਲ ਹੁੰਦੀ ਪੰਜਾਬੀ ਖਾਣਾ ਪੂਰਾ ਸਾਰਾ ਹਰੇਕ ਚੀਜ਼ ਮਿਲੂਗੀ ਤੁਹਾਨੂੰ ਹਾਂਜੀ ਚਾਹ ਇੱਥੇ ਖੰਡ ਵਾਲੀ ਚਾਹ ਮਿਲਦੀ ਆ ਗੁੜ ਵਾਲੀ ਚਾਹ ਮਿਲਦੀ ਆ ਹਾਂਜੀ ਗੁੜ ਵਾਲੀ ਚਾਹ ਵੀ ਮਿਲੂਗੀ ਹਾਂਜੀ ਇੱਕ ਨੰਬਰ ਚਾਹ ਮਿਲੁਗੀ ਤੁਹਾਨੂੰ ਜਿਹੜੀ ਪੰਜਾਬੀ ਕਹਿ ਦਿੰਦੇ ਵੀ ਡਾਂਗ ਵਰਗੀ ਚਾਹ ਪੀਣੀ ਆ ਉਹ ਚਾਹ ਮਿਲੇਗੀ ਤੁਹਾਨੂੰ ਸਾਡੇ ਢਾਬੇ 'ਤੇ ਹਾਂਜੀ ਆਇਓ ਤੁਸੀਂ ਜ਼ਰੂਰ ਸੇਵਾ ਦਾ ਮੌਕਾ ਦੇਣਾ ਸਾਨੂੰ

ਪੰਜਾਹ ਰੁਪਏ ਪਰ ਥਾਲੀ ਹੈ ਜੀ ਹਾਂਜੀ ਹਾਂਜੀ ਖਾਣਾ ਵਧੀਆ ਇੱਕ ਨੰਬਰ ਮਿਲੂਗਾ ਤੁਹਾਨੂੰ ਖਾਣੇ ਵੱਲ ਕੋਈ ਕੰਪਲੇਂਟ ਨਹੀਂ ਰੇਟ ਆਪਣਾ ਫਿਰ ਉਹ ਜ਼ਿਆਦਾ ਰੇਟ ਵਾਲੀ ਕੋਈ ਇੰਨਾ ਵਧੀਆ ਖਾਣਾ ਨਹੀਂ ਨਾ ਦਿੰਦੇ ਗੇ ਆਪਾਂ ਨਾ ਰੇਟ ਵੀ ਜਾਈਜ਼ ਆ ਵੀ ਖਾਣ ਵਾਲੇ ਨੂੰ ਕੋਈ ਦਿੱਕਤ ਵੀ ਨਾ ਹੋਵੇ ਪੈਸੇ ਦੀ ਅਤੇ ਖਾਣਾ ਵੀ ਵਧੀਆ ਭਰ ਪੇਟ ਮਿਲੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਠੀਕ ਆ ਜੀ ਧੰਨਵਾਦ ਜੀ